ਭੰਗੜਾ ਤਾਂ ਪੰਜਾਬੀ ਭਾਈਚਾਰੇ ਦਾ ਹੀ ਹਿੱਸਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨੂੰ ਪ੍ਰਗਟ ਕਰਨ ਦੇ ਲਈ ਭੰਗੜਾ ਪੰਜਾਬ ਦੇ ਵਿੱਚ ਪਹਿਲੇ ਨੰਬਰ 'ਤੇ ਆਧਾਰ 'ਤੇ ਪਾਇਆ ਜਾਂਦਾ ਹੈ ਚਾਹੇ ਉਹ ਕਿਸੇ ਵੀ ਪੰਜਾਬ ਦੇ ਕੋਨੇ ਕੋਨੇ ਵਿੱਚ ਕਿਸੇ ਵੀ ਜਗ੍ਹਾ 'ਤੇ ਕੋਈ ਵੀ ਖੁਸ਼ੀ ਦਾ ਤਿਉਹਾਰ ਹੋਵੇ ਭੰਗੜੇ ਤੋਂ ਬਿਨਾਂ ਉਹ ਪੂਰਾ ਨਹੀਂ ਹੁੰਦਾ ਜਿਵੇਂ ਪੰਜਾਬ ਦੇ ਸਾਰੇ ਤਿਉਹਾਰ ਭੰਗੜੇ ਨਾਲ ਹੀ ਜ਼ਿਆਦਾਤਰ ਜੁੜੇ ਹਨ ਵਿਸਾਖੀ ਦੇ ਮੌਕੇ 'ਤੇ ਕਣਕ ਵੱਢਣ ਤੋਂ ਲੈ ਕੇ ਬੀਜਣ ਤੋਂ ਲੈ ਕੇ ਵੱਢਣ ਤੱਕ ਵੀ ਭੰਗੜੇ ਨਾਲ ਹੀ ਇਹ ਤਿਉਹਾਰ ਸੰਬੰਧਿਤ ਹੈ ਭਾਰਤ ਵਿੱਚ ਕਿਸੇ ਵੀ ਜਗ੍ਹਾ 'ਤੇ ਚਾਹੇ ਉਹ ਪੂਰੇ ਭਾਰਤ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਕੋਨਾ ਹੈ ਉਹਦੇ ਵਿੱਚ ਭੰਗੜਾ ਹਰ ਰੂਹ ਦੇ ਵਿੱਚ ਵੱਸਦਾ ਹੈ ਅਤੇ ਬੱਚੇ ਦੇ ਜੰਮਣ ਤੋਂ ਲੈ ਕੇ ਉਹਦੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਮਨਾਉਣ ਤੋਂ ਲੈ ਕੇ ਉਹਦੇ ਵਿੱਚ ਭੰਗੜੇ ਦਾ ਵੱਧ ਯੋਗਦਾਨ ਰਹਿੰਦਾ ਹੈ ਜਦੋਂ ਬੱਚੇ ਦੀ ਛਟੀ ਮਨਾਈ ਜਾਂਦੀ ਹੈ ਤਦ ਵੀ ਭੰਗੜਾ ਹੁੰਦਾ ਹੈ ਔਰ ਬੱਚੇ ਦੇ ਹਰ ਕਾਰ ਵਿਹਾਰ ਦੇ ਵਿੱਚ ਭੰਗੜੇ ਭੰਗੜੇ ਦਾ ਪਹਿਲੇ ਨੰਬਰ 'ਤੇ ਹੀ ਅਧਾਰ ਹੈ